ਪੰਜ ਸਤੰਬਰ ਦੋ ਹਜ਼ਾਰ ਚੌਵੀ ਬਾਈ ਫਰਵਰੀ ਦੋ ਹਜ਼ਾਰ ਪੰਦਰਾਂ ਸਤਾਈ ਮਾਰਚ ਦੋ ਹਜ਼ਾਰ ਚੌਵੀ ਦੋ ਅਪ੍ਰੈਲ ਦੋ ਹਜ਼ਾਰ ਚੌਵੀ ਸੱਤ ਜੂਨ ਦੋ ਹਜ਼ਾਰ ਪੰਜ